ਸਾਡੇ ਘਰਾਂ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਵਿੱਚੋਂ ਅਕਸਰ ਕੋਈ ਨਾ ਕੋਈ ਬੱਚਾ ਬਜ਼ੁਰਗ ਜਾਂ ਕੋਈ ਵੀ ਜਿਹੜਾ ਉਹ ਬਿਮਾਰ ਹੋ ਜਾਂਦਾ ਜਿਵੇਂ ਮੰਨ ਲਉ ਅਗਰ ਕਿਸੇ ਦਾ ਪੇਟ ਨਹੀਂ ਠੀਕ ਹੈਗਾ ਤਾਂ ਅਸੀਂ ਹਮੇਸ਼ਾ ਖਿਚੜੀ ਬਣਾਉਂਦੇ ਹਾਂ ਜਿਵੇਂ ਮੂੰਗੀ ਮਸਰੀ ਦੀ ਦਾਲ ਅੱਧੋ ਸੁਧ ਮੂੰਗੀ ਮਸਰੀ ਦੀ ਦਾਲ ਅਤੇ ਅੱਧੋ ਸੁਧ ਚੌਲ ਪਾ ਕੇ ਜਿਹੜੇ ਬ ਬਿਮਾਰ ਹੁੰਦੇ ਨੇ ਉਹਨਾਂ ਲਈ ਇਹ ਬਹੁਤ ਵਧੀਆ ਰਹਿੰਦੀ ਹੈ ਜਿਵੇਂ ਹੁਣ ਮੰਨ ਲਉ ਸਰਦੀ ਦਾ ਮੌਸਮ ਹੈ ਤਾਂ ਅਕਸਰ ਹੀ ਜ਼ੁਕਾਮ ਹੋ ਜਾਂਦਾ ਜਾਂ ਫਿਰ ਖਾਂਸੀ ਹੋ ਜਾਂਦੀ ਹੈ ਤਾਂ ਫਿਰ ਘਰਾਂ ਦੇ ਵਿੱਚ ਸੀਰਾ ਬਣਾਇਆ ਜਾਂਦਾ ਜਿਵੇਂ ਆਟਾ ਭੁੰਨ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਲਿਕੁਅਡ ਹੁੰਦਾ ਪਾਣੀ ਜ਼ਿਆਦਾ ਪਾ ਕੇ ਥੋੜ੍ਹਾ ਜਿਹਾ ਦੇਸੀ ਘਿਓ ਪਾ ਕੇ ਅਤੇ ਰਾਤ ਨੂੰ ਸੌਣ ਲਈ ਦਿੱਤਾ ਜਾਂਦਾ ਅਤੇ ਉਸਦੇ ਉੱਪਰੋਂ ਕੋਈ ਪਾਣੀ ਵਗੈਰਾ ਠੰਡੀ ਚੀਜ਼ ਨਹੀਂ ਲੈਣੀ ਹੁੰਦੀ ਅਤੇ ਉਹ ਵੀ ਸਰਦੀਆਂ ਦੇ ਵਿੱਚ ਜ਼ੁਕਾਮ ਦੇ ਲਈ ਬਹੁਤ ਚੰਗਾ ਸਮਝਿਆ ਜਾਂਦਾ ਤਾਂ ਇਸ ਪ੍ਰਕਾਰ ਜਿਵੇਂ ਅਗਰ ਕਿਸੇ ਨੂੰ ਕੋਈ ਸਖਤ ਭੋਜਨ ਜਿਹੜਾ ਉਹ ਛੇਤੀ ਹਜ਼ਮ ਨਹੀਂ ਹੁੰਦਾ ਕਿਸੇ ਨੂੰ ਕੋਈ ਬਦਹਜ਼ਮੀ ਹੋ ਜਾਂਦੀ ਹੈ ਤਾਂ ਖਿਚੜੀ ਦੇ ਨਾਲ ਨਾਲ ਥੋੜ੍ਹਾ ਜਿਹਾ ਜਿਵੇਂ ਦਲੀਆ ਵੀ ਜਿਹੜਾ ਪਤਲਾ ਉਹ ਬਣਾਇਆ ਜਾਂਦਾ ਘਰਾਂ ਦੇ ਵਿੱਚ ਅਤੇ ਇਸਦੇ ਨਾਲ ਖਿਚੜੀ ਦਲੀਆ ਜਾਂ ਸੀਰਾ ਇਹਨਾਂ ਇਹ ਤਿੰਨੋਂ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਕਿਸੇ ਬਿਮਾਰ ਵਾਸਤੇ ਬਣਾ ਬਣਾਈਆਂ ਜਾਂਦੀਆਂ ਨੇ ਉਸਦਾ ਹਾਜ਼ਮਾ ਵੀ ਦਰੁਸਤ ਰਹਿੰਦਾ ਅਤੇ ਬਹੁਤ ਛੇਤੀ ਉਹ ਠੀਕ ਵੀ ਹੋ ਜਾਂਦਾ